ਇੱਕ ਨਵੰਬਰ ਉੱਨੀ ਸੌ ਤਿਰਾਨਵੇਂ ਪੰਜ ਮਈ ਉੱਨੀ ਸੌ ਅਠਾਨਵੇਂ ਵੀਹ ਮਾਰਚ ਉੱਨੀ ਸੌ ਇਕੱਹਤਰ ਤੀਹ ਮਾਰਚ ਉੱਨੀ ਸੌ ਉਨ੍ਹੱਤਰ ਤੀਹ ਅਗਸਤ ਦੋ ਹਜ਼ਾਰ ਤੇਈ